ਮੈਂ ਜਿਸ ਪਿੰਡ ਵਿੱਚ ਰਹਿੰਦਾ ਹਨ ਉਸ ਵਿੱਚ ਕਈ ਬਜ਼ੁਰਗ ਲੋਕ ਹਨ ਅਤੇ ਉਹ ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ ਹਨ ਇੱਕ ਤਾਂ ਉਹ ਸਾਡੇ ਪਿੰਡ ਵਿੱਚ ਇੱਕ ਦਰਖਤ ਹੈ ਉੱਥੇ ਜਾ ਕੇ ਕਈ ਬਜ਼ੁਰਗ ਇਕੱਠੇ ਹੋ ਕੇ ਤਾਂਸ਼ ਖੇਡਦੇ ਹਨ ਅਤੇ ਆਪਣਾ ਟਾਈਮ ਸਪੈਂਡ ਕਰਦੇ ਹਨ ਅਤੇ ਦੂਜਾ ਬਜ਼ੁਰਗ ਲੋਕਾਂ ਨੂੰ ਸ਼ਤਰੰਜ ਖੇਡਣੇ ਦਾ ਵੀ ਬਹੁਤ ਸ਼ੌਕ ਹੁੰਦਾ ਹੈ ਉਹ ਵਿਹਲੇ ਟਾਈਮ 'ਚ ਸਤਰੰਜ ਵੀ ਖੇਡਦੇ ਹਨ ਅਤੇ ਸ ਕਈ ਵਾਰ ਮੈਂ ਸਵੇਰੇ ਉਹਨਾਂ ਨੂੰ ਦੇਖਿਆ ਹੈ ਉਹ ਸਵੇਰੇ ਸਵੇਰੇ ਰਨਿੰਗ ਵੀ ਕਰਦੇ ਹਨ ਉਹਨਾਂ ਨੂੰ ਸ ਰਨਿੰਗ ਕਰਨ ਦਾ ਬੜਾ ਸ਼ੌਕ ਹੁੰਦਾ ਹੈ ਉਹ ਵੀ ਇਸ ਚੀਜ਼ 'ਚ ਸ਼ਾਮਿਲ ਨੇ ਹੋਰ ਬਜ਼ੁਰਗ ਆਪਣੇ ਹਿਸਾਬ ਨਾਲ ਜੋ ਜੋ ਉਹਨਾਂ ਨੂੰ ਸਹੀ ਲੱਗਦਾ ਉਹ ਕਰਦੇ ਨੇ